ਮੇਰੇ ਮੁਤਾਬਿਕ ਜਿਹੜਾ ਸਾਡਾ ਪੰਜਾਬ ਰਾਜ ਆ ਔਰ ਪੰਜਾਬ ਸਟੇਟ ਜਿਹਨੂੰ ਅਸੀਂ ਕਹਿੰਦੇ ਹਾਂ ਦੇਸ਼ ਦੀ ਤਰੱਕੀ ਵਿੱਚ ਕਾਫੀ ਯੋਗਦਾਨ ਪਾਉਂਦਾ ਪੰਜਾਬ ਜਿਹੜਾ ਵਾ ਉਹ ਸਾਡੇ ਦੇਸ਼ ਦਾ ਇੱਕ ਰਾਜ ਆ ਉਹ ਜਿਹਦੇ ਵਿੱਚ ਸਾਡਾ ਪੰਜਾਬ ਕਲਾ ਸਾਹਿਤ ਅਤੇ ਵਿਗਿਆਨ ਦੇ ਖੇਤਰ ਵਿੱਚ ਇਸ ਨੇ ਕਾਫੀ ਯੋਗਦਾਨ ਪਾਏ ਹੈ ਕਲਾ ਦੇ ਪੱਖੋਂ ਅਸੀਂ ਜੇ ਜਾਣੀਏ ਤਾਂ ਜੇ ਅਸੀਂ ਗਾਇਕੀ ਪੱਖੋਂ ਕਹਿ ਸਕਦੇ ਹਾਂ ਗਾਇਕੀ ਪੱਖੋਂ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਅੱਛੇ ਗੀਤ ਗਾ ਕੇ ਲੋਕਾਂ ਨੂੰ ਸਹੀ ਨਸੀਹਤਾਂ ਦਿੱਤੀਆਂ ਜਿਵੇਂ ਕੁਛ ਗਾਣੇ ਐਸੇ ਹੁੰਦੇ ਆ ਜਿਹਨਾਂ ਵਿੱਚੋਂ ਲੋਕਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਜਿਵੇਂ ਪਿੱਛੇ ਜੇ ਇੱਕ ਗਾਣਾ ਆਇਆ ਸੀ ਪਾਣੀ ਹੋ ਕੇ ਡੂੰਘੇ ਝੋਨਾ ਲਾਉਣਾ ਛੱਡ ਦੇਣਾ ਉਹ ਤੋਂ ਸਾਨੂੰ ਸਿੱਖਣ ਮਿਲਦੀ ਸੀ ਕਿ ਝੋਨਾ ਘੱਟ ਲਾਉਣਾ ਚਾਹੀਦਾ ਕਿਉਂਕਿ ਉਹ ਪਾਣੀ ਜ਼ਿਆਦਾ ਪੀਂਦਾ ਸੋ ਉਹਦੇ ਵਿੱਚ ਵਿੱਚ ਸਾਹਿਤ ਦੇ ਮਾਮਲੇ ਵਿੱਚ ਵਿਗਿਆਨ ਦੇ ਮਾਮਲੇ ਵਿੱਚ ਪੰਜਾਬ ਦੇ ਬਹੁਤ ਸਾਰੇ ਐਸੇ ਵਿਗਿਆਨਿਕ ਨੇ ਜਿਹਨਾਂ ਨੇ ਅੱਛੀਆਂ ਅੱਛੀਆਂ ਖੋਜਾਂ ਕਰਕੇ ਪੰਜਾਬ ਨੂੰ ਔਰ ਸ ਸਾਡੇ ਦੇਸ਼ ਨੂੰ ਜਿਹੜਾ ਵਾ ਅੱਗੇ ਬੜੀ ਅੱਗੇ ਤਰੱਕੀ ਦਿੱਤੀ ਆ ਸਾਹਿਤ ਦੇ ਮਾਮਲੇ 'ਚ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਵਿੱਚੋਂ ਕਾਫੀ ਇਸ ਤਰ੍ਹਾਂ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਲਿਖਾਰੀ ਪੈਦਾ ਹੋਏ ਨੇ ਜਿਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਲਿਖਤਾਂ ਨੂੰ ਸੁਣ ਕੇ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਾਫੀ ਮਾਣ ਮਹਿਸੂਸ ਕਰਦੇ ਆ ਜਿਵੇਂ ਉਹਨਾਂ ਵਿੱਚੋਂ ਅਸੀਂ ਸ਼੍ਰੀ ਸੁਰਜੀਤ ਪਾਤਰ ਜੀ ਦੀ ਗੱਲ ਕਰ ਲਈਏ ਜਾਂ ਅਸੀਂ ਭਾਈ ਵੀਰ ਸਿੰਘ ਜੀ ਦੀ ਗੱਲ ਕਰ ਲਈਏ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਗੱਲ ਕਰ ਲਈ ਜਿਹਨਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਇਹਨਾਂ ਦੀਆਂ ਕਹਾਣੀਆਂ ਬਲਰਾਜ ਸਾਹਨੀ ਜੀ ਨਰਿੰਦਰ ਕਪੂਰ ਜੀ ਕਾਫੀ ਬੇਸ਼ੁਮਾਰ ਸ਼ਿਵ ਕੁਮਾਰ ਬਟਾਲਵੀ ਜੀ ਇੰਨੇ ਬੇਸ਼ੁਮਾਰ ਨਾਮ ਨੇ ਜਿਹਨਾਂ ਨੇ ਪੰਜਾਬ ਦੇ ਸਾਹਿਤ ਨੂੰ ਕਲਾ ਨੂੰ ਔਰ ਵਿਗਿਆਨ ਨੂੰ ਮੁੱਖ ਯੋਗਦਾਨ ਦਿੱਤੇ ਆ ਜਿਹਦੇ ਕਰਕੇ ਸਾਡਾ ਪੰਜਾਬ ਸਾਡਾ ਦੇਸ਼ ਜਿਹੜਾ ਵਾ ਕਾਫੀ ਤਰੱਕੀ ਦੇ ਪਾਸੇ ਵੱਧ ਰਿਹਾ ਵਾ ਔਰ ਮੈਨੂੰ ਵੀ ਲੱਗਦਾ ਕਿ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਜਿਹਦੇ ਕਰਕੇ ਕਲਾ ਸਾਹਿਤ ਅਤੇ ਵਿਗਿਆਨ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਧੰਨਵਾਦ